ਤਾਰਿਆਂ ਬਾਰੇ ਬਚਪਨ ਵਿੱਚ ਬੜਾ ਕੁਛ ਸੁਣਿਆ ਹੋਇਆ ਹੈ ਕਿਉਂਕਿ ਤਾਰਿਆਂ ਵਿੱਚ ਰਾਤੀ ਜਦੋਂ ਉਦੋਂ ਉੱਪਰ ਸੌਣ ਦਾ ਮੌਸਮ ਜ਼ਮਾਨਾ ਹੁੰਦਾ ਸੀ ਲੋਕ ਸਾਰੇ ਮੰਜੇ ਡਾਹ ਕੇ ਉੱਪਰ ਸੌਂਦੇ ਸੀ ਅਤੇ ਤਾਰਿਆਂ ਬਾਰੇ ਸਾਡੇ ਮਾਂ ਪਿਓ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਕਿ ਟੁੱਟਦਾ ਤਾਰਾ ਦੇਖੋ ਅਤੇ ਕੋਈ ਵਿਸ਼ ਮੰਗੋ ਅਤੇ ਉਹ ਪੂਰੀ ਹੋ ਜਾਂਦੀ ਹੈ ਜਾਂ ਬਚਪਨ ਉਦੋਂ ਇੰਨਾਂ ਕੁ ਸੀ ਅਨਜਾਨ ਹੁੰਦਾ ਸੀ ਬਚਪਨ ਬੜਾ ਮਾਸੂਮ ਹੁੰਦਾ ਸੀ ਅਤੇ ਅਸੀਂ ਤਾਰੇ ਗਿਣਦੇ ਗਿਣਦੇ ਸੌ ਜਾਂਦੇ ਹੁੰਦੇ ਸੀ ਲੇਕਿਨ ਤਾਰੇ ਤਾਂ ਅਣਗਿਣਤ ਉਹਨਾਂ ਨੂੰ ਕੋਈ ਨਹੀਂ ਦੇਖ ਸਕਦਾ ਉਹਨਾਂ ਨੂੰ ਦੇਖ ਤਾਂ ਹਰ ਕੋਈ ਸਕਦਾ ਲੇਕਿਨ ਗਿਣ ਕੋਈ ਨਹੀਂ ਸਕਦਾ ਪਰ ਉਦੋਂ ਬਚਪਨਾ ਸੀ ਅਤੇ ਅਸੀਂ ਤਾਰੇ ਹੀ ਗਿਣਨ ਬਹਿ ਜਾਂਦੇ ਹੁੰਦੇ ਸੀ ਕਈ ਕਹਿੰਦੇ ਆ ਕਿ ਤਾਰਿਆਂ ਨੂੰ ਦੇਖੋ ਅਤੇ ਕਈ ਕਹਿੰਦੇ ਸੀ ਕਿ ਮਾਂ ਪਿਓ ਕਹਿੰਦੇ ਸੀਗੇ ਹੀ ਇਨਸਾਨ ਜਦੋਂ ਮਰ ਜਾਂਦਾ ਤਾਂ ਤਾਰਿਆਂ ਦੇ ਰੂਪ ਵਿੱਚ ਤੁਹਾਨੂੰ ਆਸਮਾਨ ਤੋਂ ਦੇਖਦਾ ਹੁੰਦਾ ਹੈ ਇਸ ਤਰ੍ਹਾਂ ਹੀ ਮੇਰਾ ਬੱਚਾ ਸੀ ਇਹ ਸਾਡੇ ਬਜ਼ੁਰਗ ਸੀ ਉਹਨਾਂ ਦੀ ਡੈਥ ਹੋ ਗਈ ਅਤੇ ਮੇਰਾ ਬੱਚਾ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਤਾਰੇ ਦੇ ਰੂਪ ਵਿੱਚ ਹੀ ਕਹਿੰਦੀ ਸੀ ਕਿ ਮੇਰੇ ਚਾਚਾ ਜੀ ਉੱਪਰ ਹੈ ਮੈਂ ਚਾਚਾ ਜੀ ਨੂੰ ਵੇਖ ਰਹੀ ਹਾਂ ਉਹ ਵੇਖੋ ਮੇਰੇ ਚਾਚਾ ਜੀ ਮੈਨੂੰ ਵੇਖ ਰਹੇ ਆ ਬਸ ਇਸ ਤਰ੍ਹਾਂ ਹੀ ਕਰਦੇ ਕਰਦੇ ਉਹਨੂੰ ਹੌਲੀ ਹੌਲੀ ਹੌਂਸਲਾ ਆ ਗਿਆ ਔਰ ਤਾਰਿਆਂ ਨੂੰ ਵੇਖਦੇ ਵੇਖਦੇ ਹੀ ਕਦੇ ਅਸੀਂ ਬਚਪਨ 'ਚ ਸੌ ਵੀ ਜਾਂਦੇ ਸੀ ਸਾਨੂੰ ਬੜਾ ਅੱਛਾ ਲੱਗਦਾ ਸੀ ਆਸਮਾਨ ਕਿ ਮੰਮੀ ਤਾਰੇ ਨਿਕਲ ਆਏ ਮੰਮੀ ਤਾਰੇ ਨਿਕਲ ਆਏ ਤਾਰੇ ਟਿਮਟਮਾਂਦੇ ਬੜੇ ਹੀ ਚੰਗੇ ਲੱਗਦੇ ਹੈ ਔਰ ਕਦੇ ਕਹਿੰਦੇ ਆ ਕਿ ਸਪਤਰਿਸ਼ੀ ਤਾਰਾ ਵੀ ਅਸੀਂ ਵੇਖਦੇ ਹਾਂ ਕਦੇ ਕਦੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਅਕ੍ਰਿਤੀਆਂ ਦੇਖਦੇ ਹਾਂ ਤਾਰਿਆਂ ਦੇ ਰੂਪ ਵਿੱਚ ਕਦੇ ਕੋਈ ਘੋੜਾ ਬਣਿਆ ਹੁੰਦਾ ਕਦੇ ਕੋਈ ਹਾਥੀ ਬਣਿਆ ਹੁੰਦਾ ਕਦੇ ਅਸੀਂ ਤਾਰੇ ਨੂੰ ਟੁੱਟਦੇ ਵੀ ਦੇਖਦੇ ਹਾਂ ਬਸ ਇਸ ਤਰ੍ਹਾਂ ਹੀ ਇਤਿਹਾਸ ਸਾਡਾ ਮਿਥਿਹਾਸ ਹੈ ਔਰ ਸਾਡੇ ਮਾਂ ਪਿਓ ਨੇ ਸਾਨੂੰ ਤਾਰਿਆਂ ਬਾਰੇ ਕਿਹਾ ਕਿ ਤਾਰਾ ਚਮਕਦਾ ਪਿਆ ਉਹ ਵੇਖੋ ਕਿਸ ਤਰ੍ਹਾਂ ਲੱਗ ਰਿਹਾ ਔਰ ਅਸੀਂ ਬਚਪਨ 'ਚ ਇਹ ਕੁਛ ਬੜਾ ਕੀਤਾ ਕਿ ਅਸੀਂ ਤਾਰੇ ਗਿਣਦੇ ਗਿਣਦੇ ਹੀ ਸੌ ਜਾਂਦੇ ਸੀ